ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਇਹ ਪਹਿਲਾਂ ਕਿੰਨੇ ਸਾਲ ਕਰਵਾਈ ਸੀ ਪਹਿਲਾਂ ਇਹ ਪਲੰਬਰ ਇਹ ਪਲੰਬਿੰਗ ਸਾਰੀ ਅੱਛਾ ਅੱਛਾ ਪਹਿਲਾਂ ਮਤਲਬ ਕਰਵਾਈ ਸੀ ਅੱਛਾ ਤਿੰਨ ਚਾਰ ਸਾਲ ਹੋ ਗਏ ਹੁਣ ਲੀਕੇਜ ਕਿਸ ਤਰ੍ਹਾਂ ਦੀ ਆ ਰਹੀ ਮਤਲਬ ਵਿੱਚ ਪਾਈਪ ਦੇ ਲੀਕੇਜ ਆ ਰਹੀ ਹੈ ਜਾਂ ਨਲ ਵਗੈਰਾ ਜਾਂ ਉਹਦੇ 'ਚ ਪਾਈਪ ਦਿਵਾਰਾਂ 'ਚ ਵੀ ਲੀਕੇਜ ਆਉਣ ਲੱਗ ਗਈ ਹਾਂਜੀ ਹਾਂਜੀ ਉਹ ਫੇਰ ਨਾ ਪਾਈਪ ਦੇ ਵਿੱਚ ਜਾਂ ਕੋਈ ਵਿੱਚੋਂ ਜਿਵੇਂ ਟੁੱਟ ਗਿਆ ਜਾਂ ਕੋਈ ਖਰਾਬ ਹੋ ਗਈ ਆ ਉਹ ਆਪਾਂ ਹੁਣ ਬਦਲਣੀ ਪੈਣੀ ਆ ਇਹ ਤਾਂ ਹਾਂਜੀ ਅਤੇ ਇਹ ਫੇਰ ਜਿਹੜਾ ਸਾਰਾ ਸਮਾਨ ਚਾਹੀਦਾ ਉਹ ਵੀ ਫੇਰ ਆਪਾਂ ਨੂੰ ਚਾਹੀਦਾ ਇਹਦੇ ਲਈ ਲਿਆਉਣਾ ਪੈਣਾ ਤੁਸੀਂ ਦੱਸੋ ਮੈਂ ਲੈ ਕੇ ਆਵਾਂ ਜਾਂ ਤੁਸੀਂ ਲੈ ਕੇ ਆਓਗੇ ਹਾਂਜੀ ਉਹ ਫੇਰ ਉਹ ਫੇਰ ਤੁਸੀਂ ਮੈਨੂੰ ਹਾਂਜੀ ਤੁਸੀਂ ਮੈਨੂੰ ਪੇਮੈਂਟ ਕਰ ਦਿਓ ਫੇਰ ਮੈਂ ਲਗਭਗ ਤੁਸੀਂ ਦੱਸੋ ਸਕੂਲ ਜਦੋਂ ਫੇਰ ਓਫ ਹੋ ਜਾਂਦਾ ਉਸ ਤੋਂ ਬਾਅਦ ਹੀ ਆਊਂਗਾ ਨਾ ਹਾਂ ਉਹੀ ਤਾਂ ਹੈ ਉਸ ਤੋਂ ਬਾਅਦ ਫੇਰ ਆਊਂਗਾ ਫੇਰ ਫ੍ਰੀ ਟਾਈਮ ਨਾ ਕੋਈ ਡਿਸਟਰਬ ਕਰੇਗਾ ਉਸ ਟੈਮ ਮੈਂ ਆ ਜੂੰਗਾ ਹਾਂ ਹਾਂ ਕੋਈ ਨਾ ਤਿੰਨ ਹਾਂ ਤਿੰਨ ਵਜੇ ਤੋਂ ਬਾਅਦ ਮੈਂ ਚਲੋ ਆ ਜੂੰਗਾ ਤੁਹਾਡੇ ਕੋਲ ਤਾਂ ਚਾਰ ਵਜੇ ਪਹੁੰਚ ਜੂੰਗਾ ਚਾਰ ਵਜੇ ਹਾਂਜੀ ਹਾਂਜੀ ਉਹ ਤਾਂ ਹਾਂਜੀ ਲੋੜ ਪਵੇਗੀ ਤੁਹਾਡੀ ਵੀ ਸਾਹਮਣੇ ਤੁਸੀਂ ਦੱਸੋਗੇ ਫੇਰ ਲੀਕੇਜ ਕਿੱਥੋਂ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਉਹ ਤਾਂ ਫੇਰ ਤੁਸੀਂ ਮੈਨੂੰ ਦੱਸ ਦਿਓ ਨਾ ਦੇਖ ਕੇ ਕਿਹੜੀ ਕਿਹੜੀ ਪਈ ਹੈ ਸਮਾਨ ਅਤੇ ਕਿਹੜਾ ਕਿਹੜਾ ਲੈ ਕੇ ਆਉਣਾ ਹੈ ਉਸ ਹਿਸਾਬ ਨਾਲ ਫੇਰ ਲੈ ਆਉਂਗੇ ਫੇਰ ਐਵੇਂ ਪੈਸੇ ਆਪਾਂ ਕਿਓਂ ਵੇਸਟ ਕਰਨੇ ਆ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਪਾਂ ਵਧੀਆ ਤਰੀਕੇ ਸਹੀ ਕਰ ਦਿਆਂਗੇ ਨਾਲੇ ਬੱਚਿਆਂ ਦਾ ਕੰਮ ਹੈ ਸਕੂਲ ਦਾ ਹਾਂਜੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਈਦੀ ਮੇਰੇ ਮੇਰਾ ਜੀ ਤਾਂ ਇਹ ਹਿਸਾਬ ਕਿਤਾਬ ਹੈ ਚਲੋ ਬੱਚਿਆਂ ਦਾ ਕੰਮ ਹੈ ਜੀ ਸਕੂਲ ਦਾ ਤੁਸੀਂ ਆਪਦੇ ਹਿਸਾਬ ਕਿਤਾਬ ਚਲੋ ਜਿੰਨਾ ਆਪਾਂ ਨੂੰ ਦਿਹਾੜੀ ਦੇ ਹਿਸਾਬ ਓਸ ਤਰੀਕੇ ਦੇ ਦਿਓ ਜ਼ਿਆਦਾ ਆਪਾਂ ਕੋਈ ਲੈਣੇ ਵੀ ਨਹੀਂ ਜ਼ਿਆਦਾ ਆਪਾਂ ਪੈਸੇ ਵੀ ਨਹੀਂ ਲੈਣੇ ਹਾਂਜੀ ਅਤੇ ਫਿਰ ਮੈਂ ਚਾਰ ਵਜੇ ਪਹੁੰਚ ਜੂੰਗਾ ਤੁਹਾਡੇ ਕੋਲ ਤੁਸੀਂ ਹੋਓਗੇ ਨਾ ਕੋਲ ਅੱਛਾ ਅੱਛਾ ਜੀ ਹਾਂ ਠੀਕ ਹੈ ਜੀ ਮੈਂ ਫਿਰ ਤੁਹਾਡੇ ਕੋਲ ਚਾਰ ਵਜੇ ਰਾਈਟ ਪਹੁੰਚ ਜੂੰਗਾ ਲਗਭਗ ਅਤੇ ਤੁਸੀਂ ਸਮਾਨ ਜਾਂ ਹੋਰ ਵੀ ਕੋਈ ਲੀਕੇਜ ਵਗੈਰਾ ਹੈ ਤੁਸੀਂ ਮੈਨੂੰ ਧਿਆਨ ਨਾਲ ਦੇਖ ਲੈਣਾ ਹਾਂਜੀ ਹਾਂਜੀ ਹਾਂਜੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਮੈਨੂੰ ਦੱਸ ਦਿਓ ਫੇਰ ਆਪਾਂ ਉਹ ਨਾਲ ਦੇ ਨਾਲ ਸਹੀ ਕਰ ਦਿਆਂਗੇ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਪਾਂ ਸਭ ਚੈੱਕ ਕਰਾਂਗੇ ਵਧੀਆ ਤਰੀਕੇ ਓਕੇ ਓਕੇ ਥੈਂਕ ਊ ਥੈਂਕ ਊ ਥੈਂਕ ਊ ਸੋ ਮੱਚ